ਜਿਹੜਾ ਨਾ ਮੇਰਾ ਪੁਰਾਣਾ ਫੋਨ ਤਾ ਮੈਂ ਵੈਸੇ ਹੀ ਇੱਕ ਦਿਨ ਦੇਖ ਰਿਹਾ ਤਾ ਔਨਲਾਈਨ ਸ਼ੋਪ 'ਤੇ ਅਤੇ ਮੈਂ ਇੱਕ ਫੋਨ ਓਡਰ ਕਰ ਲਿਆ ਵੀਵੋ ਵਾਲਿਆਂ ਦਾ ਸੀਗਾ ਬਾਏ ਬਾਰ੍ਹਾਂ ਤਾਂ ਜਦੋਂ ਉਹ ਮੈਂ ਦੇਖ ਰਿਹਾ ਸੀਗਾ ਐਡਾਂ ਦੇ ਵਿੱਚ ਤਾਂ ਇੰਨਾ ਵਧੀਆ ਲੱਗ ਰਿਹਾ ਤਾ ਕਿ ਇਹ ਫੋਟੋਆਂ ਬਹੁਤ ਵਧੀਆ ਖਿੱਚਦਾ ਹੈ ਇਹਦੀ ਵੁਆਏਸ ਬਹੁਤ ਵਧੀਆ ਉੱਪਰ 'ਤੇ ਬੋਡੀ ਵੀ ਦੇਖਣੇ 'ਚ ਵਧੀਆ ਲੱਗ ਰਹੀ ਸੀ ਐਨ ਡੈਸ਼ਿੰਗ ਲੱਗ ਰਿਹਾ ਤਾ ਅਤੇ ਸਾਰਾ ਕੁਛ ਫਿਚਰ ਵੀ ਬਹੁਤ ਦੱਸ ਰਹੇ ਤੇ ਉਹਦੀ ਰੈਮ ਦੱਸ ਰਹੇ ਤੇ ਉਹਦੇ ਵਿੱਚ ਛੇ ਬੱਤੀ ਜਦ ਕਿ ਉਹ ਜਮ੍ਹਾਂ ਹੀ ਰੱਦੀ ਸੈੱਟ ਤਾ ਜਦੋਂ ਉਹ ਮੇਰੇ ਕੋਲ ਆਇਆ ਜਦ ਮੈਂ ਉਹਦੇ ਨਾਲ ਕਿਸੇ ਨਾਲ ਵੀ ਕੋਈ ਗੱਲਬਾਤ ਕਰ ਰਿਹਾ ਤਾ ਇੱਕ ਤਾਂ ਉਹਦੀ ਸਪੀਕਰਾਂ ਦੀ ਆਵਾਜ਼ ਬਹੁਤ ਫਟੀ ਫਟੀ ਜੀ ਆ ਰਹੀ ਸੀ ਸਮਝ ਨਹੀਂ ਸੀ ਆ ਰਹੀ ਪਰੋਪਰ ਬੀ ਸਾਹਮਣੇ ਵਾਲਾ ਕਿਆ ਬੋਲ ਰਿਹਾ ਉਹਦੀ ਰੀਲ ਵੋਇਸ ਤਾਂ ਪਤਾ ਹੀ ਨਹੀਂ ਤਾ ਲੱਗਦਾ ਕੈਮਰਿਆਂ ਦੀ ਕੁਆਲਿਟੀ ਦੱਸ ਰਹੇ ਤੇ ਕਿ ਪਿੱਛੇ ਵਾਲਾ ਜਿਹੜਾ ਉਹ ਬੱਤੀ ਮੈਗਾਪਿਕਸਲ ਆ ਅਤੇ ਫਰੰਟ ਵਾਲਾ ਤੇਰਾਂ ਜਦ ਕਿ ਹੋਰ ਫੋੇਨਾਂ ਦੇ ਇੰਨੇ ਇੰਨੀ ਬੱਤੀ ਮੈਗਾਪਿਕਸਲ ਆਰ ਤੇਰਾਂ ਮੈਗਾਪਿਕਸਲ ਕੈਮਰਾ ਚਲਾਉਂਦੇ ਹੈ ਤਾਂ ਉਹਨਾਂ ਦਾ ਬਹੁਤ ਸਾਫ ਫੋਟੋ ਆਉਂਦੀ ਹੈ ਵਧੀਆ ਆਉਂਦੀਆਂ ਅਤੇ ਉਹਦੇ ਵਿੱਚ ਇੱਦਾਂ ਲੱਗ ਰਿਹਾ ਤਾ ਜਿੱਕਣਾ ਮੁਹਰੇ ਵਾਲਾ ਇੱਕ ਦੋ ਮੈਗਾਪਿਕਸਲ ਦਾ ਹੋਵੇ ਅਤੇ ਪਿੱਛੇ ਵਾਲਾ ਸੱਤ ਅੱਠ ਮੈਗਾਪਿਕਸਲ ਦਾ ਹੋਵੇ ਇਸ ਤੋਂ ਵਧੀਆ ਕੁਆਲਿਟੀ ਨਹੀਂ ਸੀ ਹੈਗੀ ਬੋਡੀ ਵੀ ਦੇਖਣੇ ਵਿੱਚ ਤਾਂ ਬਹੁਤ ਵਧੀਆ ਲੱਗ ਰਿਹਾ ਤਾ ਕਲਰ ਪਿੱਛੇ ਤੋਂ ਸ਼ਾਈਨਿੰਗ ਜਿਹੀ ਵਾਲਾ ਕਲਰ ਸੀਗਾ ਪਰ ਜਦੋਂ ਆਇਆ ਉਹ ਸਿੰਪਲ ਸੈੱਟ ਜੇ ਵਾਂਗ ਤਾ ਅਤੇ ਮੈਨੂੰ ਕੁਛ ਉਹਦੇ ਵਿੱਚ ਦੱਸ ਰਹੇ ਤੇ ਬੀ ਇਹਦੇ ਨਾਲ ਸਕਰੀਨ ਗਾਰਡ ਵੀ ਮੁਫਤ ਮਿਲੁਗਾ ਅਤੇ ਉਹਦੇ ਵਿੱਚ ਕੁਛ ਵੀ ਨਹੀਂ ਤਾ ਹੈਗਾ ਸਕਰੀਨ ਗਾਰਡ ਤਾਂ ਫੋਨ ਹੋਰ ਸੀ ਅਤੇ ਉਹਦੇ ਵਿੱਚ ਹੋਰ ਫੋਨ ਦਾ ਹੀ ਭੇਜਿਆ ਵਾ ਸੀਗਾ ਔਨਲਾਈਨ 'ਚ ਅਤੇ ਮੈਨੂੰ ਬੜਾ ਬੇਕਾਰ ਸੈੱਟ ਲੱਗਿਆ ਅਤੇ ਜਮ੍ਹਾਂ ਹੀ ਬੇਕਾਰ ਸੀਗਾ ਅਤੇ ਮੈਂ ਜਦੋਂ ਵੀ ਉਹਨੂੰ ਚਲਾਉਂਦਾ ਤਾਂ ਮੈਨੂੰ ਫਰੈਂਡ ਵੀ ਮੇਰੇ ਕਹਿੰਦੇ ਤੇ ਬੀ ਤੈਂ ਕਿੰਨੇ ਦਾ ਲਿਆ ਤਾਂ ਮੈਂ ਜਦ ਉਹਨਾਂ ਨੂੰ ਉਹਦਾ ਰੇਟ ਦੱਸਦਾ ਤਾ ਤਾਂ ਉਹ ਮੈਂ ਲਿਆ ਸੀਗਾ ਚੌਦਾਂ ਹਜ਼ਾਰ ਦਾ ਅਤੇ ਜਿਹੜੇ ਮੇਰੇ ਫਰੈਂਡ ਤੇ ਉਹ ਕਹਿੰਦੇ ਬਈ ਜਿਹੜੀ ਕੁਆਲਟੀ ਇਹਦੇ ਵਿੱਚ ਹੈ ਜਿਹੜਾ ਹਿਸਾਬ ਦਾ ਇਹ ਚੱਲਦਾ ਇਹ ਤਕਰੀਬਨ ਛੇ ਸੱਤ ਹਜ਼ਾਰ ਦਾ ਸੈੱਟ ਹੈ ਇਸ ਤੋਂ ਵਧੀਆ ਨਹੀਂ ਹੈਗਾ ਇਹ ਇਸ ਤੋਂ ਕੋਈ ਮਹਿੰਗਾ ਨਹੀਂ ਹੈਗਾ ਇਹ ਬਿਲਕੁਲ ਤੁਹਾਨੂੰ ਚੂਨਾ ਲਗਾਇਆ ਕੰਪਨੀ ਵਾਲਿਆ ਨੇ ਬਿਲਕੁਲ ਰੱਦੀ ਸੈੱਟ ਆ